ਮੈਂ ਰੀਸੈਂਟਲੀ ਗੁਪਤਾ ਬੁੱਕ ਸ਼ਾਪ ਜਲੰਧਰ ਤੋਂ ਇੱਕ ਪੈੱਨ ਪਰਚੇਜ ਕੀਤਾ ਸੀ ਉਹ ਪੈੱਨ ਦਾ ਫਲੋ ਐਡਾ ਵਧੀਆ ਸੀ ਕਿ ਮੈਨੂੰ ਉਹ ਬਹੁਤ ਪਸੰਦ ਆਇਆ ਨੋਰਮਲੀ ਮੈਂ ਪੈੱਨ ਜਿਹੜਾ ਯੂਸ ਕਰਦਾ ਸੀ ਪਹਿਲਾਂ ਕਾਫੀ ਸਾਲਾਂ ਤੋਂ ਉਹੀ ਯੂਸ ਕਰਦਾ ਆ ਰਿਹਾ ਸੀ ਲੇਕਿਨ ਇਹ ਵਾਲਾ ਪੈੱਨ ਯੂਸ ਕਰਨ ਤੋਂ ਬਾਅਦ ਮੇਰਾ ਮਨ ਬਣ ਗਿਆ ਕਿ ਮੈਂ ਇਹੀ ਪੈੱਨ ਯੂਸ ਕਰਾਂਗਾ ਅਤੇ ਮੈਂ ਕਿਸੇ ਹੋਰ ਨੂੰ ਵੀ ਅਗਰ ਰਿਕਮੈਂਡ ਕਰਨਾ ਹੋਏਗਾ ਤਾਂ ਇਹੀ ਪੈੱਨ ਰਿਕਮੈਂਡ ਕਰਾਂਗਾ ਇਸ ਪੈੱਨ ਦਾ ਫਲੋ ਵੀ ਬਹੁਤ ਅੱਛਾ ਹੈ ਇੰਕ ਬਹੁਤ ਵਧੀਆ ਹੈ ਔਰ ਸਭ ਤੋਂ ਵੱਡੀ ਗੱਲ ਕਿ ਇਹ ਹੱਥਾਂ ਦੇ ਲਈ ਬਹੁਤ ਵਧੀਆ ਰਾਈਟਿੰਗ ਦੇ ਲਈ ਬਹੁਤ ਵਧੀਆ ਹੈ ਪ੍ਰੈਸ਼ਰ ਨਹੀਂ ਪੈਂਦਾ ਇਹਦੇ ਨਾਲ ਹੱਥਾਂ ਦੇ ਉੱਤੇ ਜਿੰਨਾ ਮਰਜ਼ੀ ਲਿਖਦੇ ਰਹੋ ਪਹਿਲਾਂ ਵਾਲਾ ਪੈੱਨ ਜਿਹੜਾ ਨੋਰਮਲੀ ਮੇਰਾ ਤਿੰਨ ਦਿਨ ਚਲਦਾ ਸੀ ਢਾਈ ਜਾਂ ਤਿੰਨ ਦਿਨ ਲੇਕਿਨ ਇਹ ਪੈੱਨ ਮੇਰਾ ਜਿਹੜਾ ਹੈ ਇਹ ਪੂਰੇ ਪੰਜ ਦਿਨ ਕੱਢ ਜਾਂਦਾ ਹੈ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਇਸ ਪੈੱਨ ਤੋਂ ਬਹੁਤ ਸੈਟਿਸਫਾਈ ਹਾਂ ਥੈਂਕ ਯੂ